ਸਾਡੇ ਇੱਥੇ ਬਹੁਤ ਸਾਰੇ ਸਟੇਡੀਅਮ ਹਨ ਜਿਹਨਾਂ ਵਿੱਚ ਬਹੁਤ ਸਾਰੀਆਂ ਗੇਮਾਂ ਖੇਡਾਂ ਹੁੰਦੀਆਂ ਰਹਿੰਦੀਆਂ ਨੇ ਜਿੱਦਾਂ ਲੋਕਲ ਟੂਰਨਾਮੈਂਟ ਵੀ ਹੁੰਦੇ ਰਹਿੰਦੇ ਜਿੱਦਾਂ ਪਿੰਡਾਂ ਪੰਚਾਇਤਾਂ ਵਾਲੇ ਲੋਕ ਹੁੰਦੇ ਨੇ ਜਿਹੜੇ ਉਹ ਵੀ ਟੂਰਨਾਮੈਂਟ ਕਰਵਾਉਂਦੇ ਰਹਿੰਦੇ ਨੇ ਹਰ ਛੇ ਮਹੀਨੇ ਜਾਂ ਸਾਲ ਬਾਅਦ ਟੂਰਨਾਮੈਂਟ ਹੁੰਦਾ ਹੀ ਰਹਿੰਦਾ ਇੱਥੇ ਇੱਕ ਐੱਮ ਐੱਲ ਏ ਨੇ ਵੀ ਆਪਣੀ ਸਕੀਮ ਚਲਾਈ ਹੋਈ ਹੈ ਵੀ ਜਿੱਦਾਂ ਗਰਾਊਂਡ ਦੇ ਵਿੱਚ ਨਾ ਉਹ ਹਰ ਸਾਲ ਇੱਕ ਟੂਰਨਾਮੈਂਟ ਕਰਾਉਂਦਾ ਹੈ ਅਤੇ ਉਹਦੇ ਵਿੱਚ ਬਹੁ ਮਤਲਬ ਸਾਰੀਆਂ ਗੇਮਾਂ ਹੁੰਦੀਆਂ ਨੇ ਅਤੇ ਉਹਦੇ ਵਿੱਚ ਸਾਰੇ ਬੱਚੇ ਬਹੁਤ ਅੱਗੇ ਹੋ ਕੇ ਆਪਣਾ ਯੋਗਦਾਨ ਦਿੰਦੇ ਨੇ ਅਤੇ ਇੱਦਾਂ ਹੀ ਸਰਕਾਰ ਵੀ ਹਰ ਸਾਲ ਮਤਲਬ ਇੱਕ ਟੂਰਨਾਮੈਂਟ ਕਰੋ ਜਾਂ ਕਰਵਾਉਂਦੀ ਹੈ ਇੱਦਾਂ ਦਾ ਪ੍ਰੋਗਰਾਮ ਜਿਹਦੇ ਵਿੱਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਅਤੇ ਜਿੱਦਾਂ ਅ ਸਕੂਲਾਂ ਵਿੱਚ ਵੀ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਜਿਵੇਂ ਕਿ ਅੰਡਰ ਸੈਵਨਟੀਨ ਹੋ ਗਈਆਂ ਅੰਡਰ ਨਾਈਨਟੀਨ ਹੋ ਗਈਆਂ ਕੋਲਜ 'ਤੇ ਵੀ ਹੁੰਦੀਆਂ ਨੇ ਕੋਲਜ ਲੈਵਲ 'ਤੇ ਵੀ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਬੱਚੇ ਮਤਲਬ ਕਿ ਬਹੁਤ ਸਾਰੀਆਂ ਮੱਲਾਂ ਮਾਰਦੇ ਨੇ ਅਤੇ ਉਨ੍ਹਾਂ ਵਿੱਚੋਂ ਹੀ ਕੁਛ ਕੁ ਬੱਚੇ ਇੰਟਰਨੈਸ਼ਨਲ ਲਈ ਜਾਂਦੇ ਨੇ ਨੈਸ਼ਨਲ ਲਈ ਜਾਂਦੇ ਨੇ ਅਤੇ ਇੱਦਾਂ ਹੀ ਸਾਰਿਆਂ ਦੀ ਸਿਲੈਕਸ਼ਨ ਹੁੰਦੀ ਰਹਿੰਦੀ ਹੈ